ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਸਿੱਖ ਧਰਮ ਦੇ ਨਾਲ ਬਿਲੋਂਗ ਕਰਦਾ ਹਾਂ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਅਸੀਂ ਅਪ੍ਰੈਲ ਮਹੀਨੇ ਦੇ ਵਿੱਚ ਵਿਸਾਖੀ ਦਾ ਤਿਓਹਾਰ ਮਨਾਉਂਦੇ ਹਾਂ ਇਸਦੀ ਇਤਿਹਾਸਿਕ ਘਟਨਾ ਦੇ ਬਾਰੇ ਮੈਂ ਆਪ ਜੀ ਨੂੰ ਜਾਣੂ ਕਰਵਾਉਣਾ ਚਾਹੁੰਦਾ ਹਾਂ ਜੋ ਕਿ ਇਸ ਪ੍ਰਕਾਰ ਹੈ ਸਾਨੂੰ ਸਭ ਨੂੰ ਆਮ ਇਹ ਗੱਲ ਤਾਂ ਪਤਾ ਹੀ ਹੈ ਕਿ ਅਸੀਂ ਅਪ੍ਰੈਲ ਮਹੀਨੇ ਦੇ ਵਿੱਚ ਵਿਸਾਖੀ ਦਾ ਤਿਓਹਾਰ ਬੜੀ ਧੂਮਧਾਮ ਦੇ ਨਾਲ ਮਨਾਉਂਦੇ ਹਾਂ ਉਸ ਦਿਨ ਕਈ ਥਾਵਾਂ ਦੇ ਮੇਲੇ ਲੱਗਦੇ ਨੇ ਅਤੇ ਕਿਸਾਨ ਆਪਣੀ ਫਸਲ ਬਾਕੀਆਂ ਦੀਆਂ ਨੂੰ ਵੱਢ ਕਿ ਵੇਚ ਕੇ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਨੇ ਕਿਉਂਕਿ ਘਰ ਵਿੱਚ ਦਾਣੇ ਆ ਜਾਂਦੇ ਨੇ ਕੁਝ ਕੁ ਪੈਸੇ ਆ ਜਾਂਦੇ ਨੇ ਇਸਦੇ ਨਾਲ ਕੀ ਹੈ ਕਿਸਾਨ ਬਹੁਤ ਖੁਸ਼ ਹੁੰਦੇ ਨੇ ਪਰ ਇਸਦੇ ਨਾਲ ਹੀ ਸਾਡੇ ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਘਟਨਾ ਜਿਸਦੇ ਬਾਰੇ ਆਪ ਜੀ ਨੂੰ ਮੈਂ ਜਾਣੂ ਕਰਵਾਉਣਾ ਚਾਹੁੰਦਾ ਹਾਂ ਵਿਸਾਖੀ ਵਾਲੇ ਦਿਨ ਵੈਸੇ ਆਪਾਂ ਤੇਰਾਂ ਅਪ੍ਰੈਲ ਉੱਨੀ ਸੌ ਨੜਿਨਵੇਂ ਕਹਿ ਦਿੰਦੇ ਹਾਂ ਬੱਟ ਨਾਨਕਸ਼ਾਹੀ ਕਲੈਂਡਰ ਦੇ ਅਨੁਸਾਰ ਤੀਹ ਮਾਰਚ ਸੋਲ੍ਹਾਂ ਸੌ ਨੜਿਨਵੇਂ ਈਸਵੀ ਨੂੰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡਾ ਖਾਲਸਾ ਪੰਥ ਸਾਜਿਆ ਸੀ ਉਸ ਸਮੇਂ ਚਾਰੇ ਪਾਸੇ ਬਹੁਤ ਹੀ ਹਾਹਾਕਾਰ ਮੱਚ ਗਈ ਸੀ ਅਤੇ ਮੁਗਲਾਂ ਦੇ ਅੱਤਿਆਚਾਰ ਵਧ ਗਏ ਸੀ ਇਸ ਲਈ ਇੱਕ ਖਾਲਸੇ ਦੀ ਜਿਹੜੀ ਹੈਗੀ ਸਥਾਪਨਾ ਕਰਨੀ ਬਹੁਤ ਜ਼ਰੂਰੀ ਸੀ ਇਸ ਉਦੇਸ਼ ਨੂੰ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਹਿਬ ਵਿਖੇ ਇੱਕ ਭਾਰੀ ਇਕੱਠ ਰੱਖਿਆ ਅਤੇ ਉਸ ਇਕੱਠ ਨੂੰ ਸੰਬੋਧਿਤ ਕਰਦਿਆਂ ਗੁਰੂ ਮਹਾਰਾਜ ਨੇ ਉਸ ਇਕੱਠ ਵਿੱਚੋਂ ਆਪ ਸਟੇਜ ਉੱਪਰ ਖੜ੍ਹ ਕੇ ਆਪਣੇ ਧਰਮ ਦੀ ਰਾਖੀ ਦੇ ਲਈ ਸਭ ਤੋਂ ਪਹਿਲਾਂ ਇੱਕ ਵਿਅਕਤੀ ਦੀ ਮੰਗ ਰੱਖੀ ਵੀ ਜੋ ਵੀ ਆਪਣੇ ਧਰਮ ਪ੍ਰਤੀ ਆਪਣੀ ਜਾਨ ਕੁਰਬਾਨ ਕਰ ਸਕਦਾ ਹੈ ਉਹ ਮੇਰੇ ਕੋਲ ਸਟੇਜ 'ਤੇ ਆਵੇ ਅਤੇ ਆਪਣੇ ਧਰਮ ਤੋਂ ਨਿਛਾਵਰ ਹੋਵੇ ਇਸ ਪ੍ਰਕਾਰ ਸਾਰੇ ਓਥੇ ਜੋ ਇਕੱਠ ਸੀਗਾ ਸਾਰੇ ਚਾਰੇ ਪਾਸੇ ਸੰਨਾਟਾ ਫੈਲ ਗਿਆ ਤਾਂ ਇੱਕ ਸਿੱਖ ਇੱਕ ਪਰਸਨ ਸੀਗਾ ਸਭ ਤੋਂ ਪਹਿਲਾਂ ਆਪਾਂ ਭਾਈ ਧਰਮ ਸਿੰਘ ਦਾ ਨਾਮ ਲੈ ਸਕਦੇ ਹਾਂ ਵੀ ਭਾਈ ਧਰਮ ਸਿੰਘ ਜੀ ਖੜ੍ਹੇ ਹੋਏ ਅਤੇ ਗੁਰੂ ਜੀ ਨਾਲ ਇੱਕ ਤੰਬੂ ਵਿੱਚ ਚਲੇ ਗਏ ਅਤੇ ਜਦੋਂ ਗੁਰੂ ਜੀ ਉਸ ਤੰਬੂ ਵਿੱਚੋਂ ਬਾਹਰ ਆਏ ਤਾਂ ਉਹ ਭਾਈ ਧਰਮ ਸਿੰਘ ਜੀ ਜੋ ਪਰਸਨ ਅੰਦਰ ਤੰਬੂ 'ਚ ਗਏ ਸੀ ਉਹ ਨਾਲ ਨਹੀਂ ਬਾਹਰ ਆਏ ਸਗੋਂ ਕੀ ਆ ਗੁਰੂ ਜੀ ਤਲਵਾਰ ਜਿਹੜੀ ਹੈਗੀ ਸੀ ਖੂਨ ਦੇ ਨਾਲ ਲੱਥ ਪੱਥ ਹੋ ਕੇ ਗੁਰੂ ਜੀ ਬਾਹਰ ਆਏ ਤਾਂ ਸਾਰੇ ਪਾਸੇ ਸੰਨਾਟਾ ਫੈਲ ਗਿਆ ਕਿਉਂਕਿ ਇਹ ਕੀ ਹੋ ਗਿਆ ਕਿ ਗੁਰੂ ਜੀ ਨੇ ਸੱਚੀ ਹੀ ਅੰਦਰ ਕੋਈ ਵਿਅਕਤੀ ਗਿਆ ਅਤੇ ਉੱਪਰੋਂ ਬਾਹਰ ਜਦੋਂ ਗੁਰੂ ਜੀ ਆਏ ਤਾਂ ਜਿਹੜੀ ਉਨ੍ਹਾਂ ਦੀ ਤਲਵਾਰ ਹੈ ਉਹ ਖੂਨ ਦੇ ਨਾਲ ਲੱਥ ਪੱਥ ਹੈ ਇਸ ਪ੍ਰਕਾਰ ਗੁਰੂ ਜੀ ਨੇ ਪੰਜ ਸਿੰਘ ਆਪਣੇ ਕੋਲ ਬੁਲਾਏ ਅਤੇ ਗੁਰੂ ਜੀ ਦੇ ਬੁਲਾਵੇ 'ਤੇ ਪੰਜ ਸਿੱਖ ਜਿਹੜੇ ਪੰਜ ਸਿੰਘ ਸੀਗੇ ਉਹ ਗੁਰੂ ਜੀ ਕੋਲ ਆਏ ਅਤੇ ਗੁਰੂ ਜੀ ਵਾਰ ਵਾਰ ਤੰਬੂ ਵਿੱਚ ਲਿਜਾ ਕੇ ਅੰਦਰ ਲਿਆਉਂਦੇ ਰਹੇ ਅਤੇ ਬਾਹਰ ਆਪਣੀ ਜਿਹੜੀ ਤਲਵਾਰ ਹੈ ਉਹ ਲਹੂ ਦੇ ਨਾਲ ਲੱਥ ਪੱਥ ਲਿਆਉਂਦੇ ਰਹੇ ਇਸ ਪ੍ਰਕਾਰ ਗੁਰੂ ਜੀ ਨੇ ਪੰਜ ਸਿੰਘਾਂ ਦੀ ਚੋਣ ਕਰੀ ਅਤੇ ਬਾਅਦ ਵਿੱਚ ਸਾਰੇ ਹੈਰਾਨ ਰਹਿ ਗਏ ਕਿ ਗੁਰੂ ਜੀ ਅੰਦਰ ਇਨ੍ਹਾਂ ਨੂੰ ਲਿਜਾ ਰਹੇ ਨੇ ਪਰ ਬਾਹਰ ਨਹੀਂ ਲਿਆ ਰਹੇ ਇਨ੍ਹਾਂ ਨੂੰ ਆ ਕੇ ਲਿਆ ਮਤਲਬ ਬਾਹਰ ਨਹੀਂ ਇਨ੍ਹਾਂ ਨੂੰ ਆ ਰਹੇ ਵਾਪਸ ਪਰ ਜਦੋਂ ਗੁਰੂ ਜੀ ਨੇ ਬਾਅਦ ਵਿੱਚ ਪੰਜ ਸਿੰਘਾਂ ਨੂੰ ਇਕਦਮ ਬਾਹਰ ਲਿਆ ਕੇ ਸਾਰਿਆਂ ਦੇ ਸਾਹਮਣੇ ਉਨ੍ਹਾਂ ਪੰਜ ਸਿੰਘਾਂ ਤੋਂ ਆਪ ਅੰਮ੍ਰਿਤ ਛਕਿਆ ਅਤੇ ਬਾਅਦ ਵਿੱਚ ਪਹਿਲਾਂ ਸੋਰੀ ਗੁਰੂ ਜੀ ਨੇ ਉਨ੍ਹਾਂ ਪੰਜ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਖੰਡੇ ਬਾਟੇ ਦੀ ਪਾਹੁਲ ਤਿਆਰ ਕੀਤੀ ਉਨ੍ਹਾਂ ਨੂੰ ਪੰਜੇ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਅਤੇ ਫਿਰ ਬਾਦ ਵਿੱਚ ਉਨ੍ਹਾਂ ਸਿੰਘਾਂ ਤੋਂ ਆਪ ਅੰਮ੍ਰਿਤ ਛਕਿਆ ਇਸ ਪ੍ਰਕਾਰ ਗੁਰੂ ਜੀ ਨੇ ਇੱਕ ਖਾਲਸਾ ਸਾਜਿਆ ਪੰਜ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਅਤੇ ਖਾਲਸਾ ਸਾਜਿਆ ਇਸ ਪ੍ਰਕਾਰ ਇਹ ਘਟਨਾ ਜਿਹੜੀ ਹੈਗੀ ਹੈ ਸਾਡੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਰੱਖਦੀ ਹੈ ਉਸ ਦਿਨ ਤੋਂ ਸਾਡੇ ਖਾਲਸੇ ਦੀ ਜਿਹੜੀ ਹੈਗੀ ਹੈ ਅਸਲ ਭੂਮਿਕਾ ਜਿਹੜੀ ਆਈ ਹੈ ਸਾਹਮਣੇ ਆਈ ਹੈ ਉਸ ਦਿਨ ਤੋਂ ਅਸੀਂ ਸਿੱਖ ਇਤਿਹਾਸ ਨਾਲ ਇਹ ਜਿਹੜਾ ਹੈਗਾ ਦਿਨ ਸੰਬੰਧਿਤ ਹੈ ਵਿਸਾਖੀ ਵਾਲਾ ਦਿਨ ਉਸ ਟੈਮ ਅਸੀਂ ਕਹਿ ਸਕਦੇ ਵੀ ਸਾਡੇ ਖਾਲਸੇ ਦੀ ਹੈਗੀ ਹੈ ਸਥਾਪਨਾ ਹੋਈ ਸੀ ਉਸ ਦਿਨ ਤੋਂ ਪਿੱਛੋਂ ਹੀ ਸਾਡੇ ਜਿਹੜੇ ਹੈਗੇ ਹੈ ਆਪਣੇ ਵਿਅਕਤੀ ਨੇ ਮੰਨ ਲਓ ਬੰਦਾ ਹੈਗਾ ਜੋ ਕਿਸੇ ਦਾ ਨਾਮ ਆ ਜਸਕਰਨ ਉਹਦੇ ਬੰਦੇ ਜਸਕਰਨ ਦੇ ਪਿੱਛੇ ਸਿੰਘ ਲੱਗਿਆ ਯਾਨੀ ਕਿ ਬੰਦੇ ਦੇ ਪਿੱਛੇ ਸਿੰਘ ਲੱਗਿਆ ਅਤੇ ਔਰਤ ਪਿੱਛੇ ਕੌਰ ਲੱਗਿਆ ਇਹ ਦਿਨ ਸਾਡੇ ਸਿੱਖ ਇਤਿਹਾਸ ਵਿੱਚ ਬਹੁਤ ਜ਼ਿਆਦਾ ਅਹਿਮ ਰੋਲ ਅਦਾ ਕਰਦਾ ਹੈ ਉਸ ਦਿਨ ਗੁਰੂ ਜੀ ਨੇ ਗੁਰੂ ਮਹਾਰਾਜ ਜੀ ਨੇ ਖਾਲਸੇ ਪੰਥ ਦੀ ਸਾਜਿਆ ਸਾਜਨਾ ਕੀਤੀ ਹੈ ਇਹ ਸਾਡੇ ਸਿੱਖ ਇਤਿਹਾਸ ਵਿੱਚ ਬਹੁਤ ਹੀ ਮਹੱਤਵਪੂਰਨ ਦਿਨ ਜਿਹੜਾ ਹੈਗਾ ਆ ਉਹ ਸਿੱਖਾਂ ਲਈ ਮੰਨਿਆ ਜਾਂਦਾ ਹੈ ਅਤੇ ਹਰ ਸਾਲ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਗਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਧੂਮਧਾਮ ਦੇ ਨਾਲ ਗੁਰੂ ਜੀ ਦੀ ਯਾਦ ਦੇ ਵਿੱਚ ਮੇਲਾ ਭਰਦਾ ਹੈ ਸੰਗਤਾਂ ਹੁੰਮ ਹਮਾ ਕੇ ਪਹੁੰਚਦੀਆਂ ਨੇ ਦਰਸ਼ਨ ਕਰਨ ਦੇ ਲਈ ਅਤੇ ਸਿੱਖ ਇਤਿਹਾਸ ਵਿੱਚ ਇਹਦੀ ਬਹੁਤ ਜ਼ਿਆਦਾ ਮਹੱਤਤਾ ਵੀ ਹੈ ਇਸ ਦਿਨ ਦੀ